ਹੈਲੋ ਤੁਸੀਂ ਕਿੱਥੋਂ ਮਿਠਾਈ ਦੀ ਦੁਕਾਨ ਤੇ ਬੋਲਦੇ ਹੋ ਅੱਛਾ ਖਜੂਰ ਦੀ ਮਿਠਾਈ ਮਿਲ ਜਾਏਗੀ ਧੁੱਗਾ ਦੀ ਅੱਛਾ ਤੇ ਕੀ ਰੇਟ ਹੈ ਫੁੱਗਾ ਦੀ ਤੇ ਅੱਛਾ ਖਜੂਰ ਦੀ ਅੱਛਾ ਆਪਾ ਨੂੰ ਤੀਨ ਡੱਬੇ ਫੁੱਗਾ ਦੀ ਔਰ ਪਾਚ ਡੱਬੇ ਖਜੂਰ ਦੇ ਆਧਾ ਕਿਲੋ ਤੇ ਤਿੰਨ ਡੱਬੇ ਔਰ ਕਿਹੜੀ ਕਿਹੜੀ ਮਿਠਾਈ ਹੈ ਅੱਛਾ ਅੱਛਾ ਲੱਡੂ ਕੀ ਰੇਟ ਹੈ ਅੱਛਾ ਅੱਛਾ ਅੱਛਾ ਉਹ ਕੀ ਰੇਟ ਹੈ ਅੱਛਾ ਡੱਬੇ ਕਰ ਦੀਓ ਬਰਫੀ ਦੇ ਤੇ ਬਾਕੀ ਸਾਰਾ ਪੈਕ ਕਰ ਦੇਣਾ ਅੱਛਾ ਅੱਛਾ ਕੈ ਵਜੇ ਅੱਛਾ ਅੱਛਾ ਅੱਛਾ ਵੈ ਫਰੈਸ਼ ਮਿਠਾਈ ਹੋਤੀ ਹੈ ਬਿਲਕੁਲ ਤਾਜੀ ਅੱਛਾ ਅੱਛਾ ਕੁਆਲਿਟੀ ਕੁਆਲਿਟੀ ਸਾਫ ਸੁਥਰੀ ਚਲੋ ਫਿਰ ਪੈ ਪੈਕ ਕਰਾਨਾ ਆਪ ਠੀਕ ਹੈ ਠੀਕ ਐ ਠੀਕ ਠੀਕ